ਸ਼ੌਂਕ ਵਜੋਂ ਫੋਟੋਗ੍ਰਾਫੀ ਜ਼ਾਰੀ ਰੱਖਣ ਲਈ ਮੇਰੀ ਪ੍ਰੇਰਨਾ ਹੈ ਕਿ ਮੈਨੂੰ ਕੁਦਰਤ ਨਾਲ਼ ਬਹੁਤ ਪਿਆਰ ਹੈ ਮੈਂ ਉੱਥੇ ਦੇ ਬਹੁਤ ਚੰਗੇ ਦ੍ਰਿਸ਼ ਦੇਖਦਾ ਰਹਿੰਦਾ ਹਾਂ ਉੱਥੇ ਬਹੁਤ ਸਾਰੇ ਮਸ਼ਹੂਰ ਫੋਟੋਗ੍ਰਾਫਰ ਫੋਟੋ ਖਿੱਚਣ ਵਾਸਤੇ ਜਾਂਦੇ ਰਹਿੰਦੇ ਹਨ ਸਾਨੂੰ ਉਹਨਾਂ ਤੋਂ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਵੀ ਫੋਟੋਗ੍ਰਾਫੀ ਦਾ ਕੰਮ ਕਰ ਸਕੀਏ ਫੋਟੋਗ੍ਰਾਫੀ ਦੇ ਵਿਚ ਚੰਗਾ ਪੈਸਾ ਹੈ ਚੰਗਾ ਚੰਗਾ ਜੀਵਨ ਹੈ ਮੈਂ ਇਹ ਸੋਚਦਾ ਹਾਂ ਕਿ ਮੈਂ ਉੱਥੇ ਦੇ ਵਧੀਆ ਵਧੀਆ ਫੋਟੋ ਕਲਿੱਕ ਕਰਕੇ ਆਪਣੇ ਜੀਵਨ ਕਾਲ ਵਿੱਚ ਫੋਟੋਗ੍ਰਾਫੀ ਨਾਲ਼ ਆਪਣਾ ਜੀਵਨ ਵਧੀਆ ਬਣਾ ਸਕਦਾ ਹਾਂ